ਹਾਂ ਮੋਟਰਸਾਈਕਲ ਦੇ ਨਾਲ ਲਿਜਾਣ ਵਾਲੇ ਸਭ ਤੋਂ ਜਿਹੜੇ ਮੇਨ ਜ਼ਰੂਰੀ ਸਮਾਨ ਆ ਜਿਵੇਂ ਕਿ ਇੱਕ ਤੁਸੀਂ ਪਲੱਗ ਰੱਖ ਸਕਦੇ ਹੋ ਵਾਧੂ ਅਤੇ ਪਲੱਗ ਪਾਨਾ ਹੋਇਆ ਪੇਚਕਸ ਹੋਇਆ ਅਤੇ ਅੱਜ ਕੱਲ੍ਹ ਇੱਕ ਦੂਜੇ ਹਵਾ ਵਾਲੇ ਪੰਪ ਚੱਲੇ ਨੇ ਉਹ ਰੱਖ ਸਕਦੇ ਹੋ ਇਹ ਚੀਜ਼ਾਂ ਜ਼ਰੂਰੀ ਨੇ ਕਿਉਂਕਿ ਜੇ ਤੁਸੀਂ ਕਿਤੇ ਬਾਹਰ ਜਾ ਰਹੇ ਹੋ ਦੂਰ ਜਾ ਰਹੇ ਹੋ ਤਾਂ ਤੁਹਾਡੇ ਕੋਲ ਐ ਇੰਨਾ ਕੁ ਸਮਾਨ ਹੋਣਾ ਚਾਹੀਦਾ ਵੀ ਜੇ ਤੁਹਾਡਾ ਕ ਰਸਤੇ ਦੇ ਵਿੱਚ ਮੋਟਰਸਾਈਕਲ ਦੀ ਹਵਾ ਨਿਕਲ ਗਈ ਜਾਂ ਕੁਛ ਸਪਾਰਕ ਪਲੱਗ ਖਰਾਬ ਹੋ ਗਿਆ ਤਾਂ ਤੁਸੀਂ ਉਹਨਾਂ ਨੂੰ ਚੇਂਜ ਕਰਕੇ ਵਰਤ ਬਦਲ ਕੇ ਆਪਣਾ ਸਫ਼ਰ ਜਾਰੀ ਕਰ ਸਕਦੇ ਹੋ ਮੇਰੇ ਨਾਲ ਵੀ ਇੱਕ ਦੋ ਵਾਰ ਇੱਦਾਂ ਹੋਇਆ ਵੀ ਇੱਕ ਵਾਰ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਮੇਰੇ ਕੋਲ ਇਹ ਸਮਾਨ ਨਹੀਂ ਸੀ ਮੋਟਰਸਾਈਕਲ ਪੈਂਚਰ ਹੋ ਗਿਆ ਸੀ ਉਹ ਪੈਂਚਰ ਲਵਾਉਣ ਲਈ ਮੈਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਮੇ ਦੁਕਾਨ ਜਿੱਥੇ ਮੈਂ ਜਾ ਰਿਹਾ ਸੀ ਉਹ ਮੈਂ ਬਹੁਤ ਪਿੰਡ ਦੇ ਵਿੱਚ ਸੀ ਅਤੇ ਦੁਕਾਨ ਮੇਰੇ ਤੋਂ ਘੱਟੋ ਘੱਟ ਪੰਦਰ੍ਹਾਂ ਮੇਰੇ ਵੀਹ ਕਿਲੋਮੀਟਰ 'ਤੇ ਦੂਰੀ 'ਤੇ ਸੀਗੀ ਅਤੇ ਨਾ ਮੈਂ ਉੱਥੇ ਕਿਸੇ ਨੂੰ ਜਾਣਦਾ ਸੀ ਅਤੇ ਮੋਟਰਸਾਈਕਲ ਤਾਂ ਪੈਂਚਰ ਨਾ ਮੈਂ ਉੱਥੇ ਮੋਟਰਸਾਈਕਲ ਛੱਡ ਸਕਦਾ ਸੀਗਾ ਫਿਰ ਮੈਂ ਆਪਣੇ ਕਿਸੇ ਯਾਰ ਦੋਸਤ ਨੂੰ ਮਿੱਤਰ ਨੂੰ ਫੋਨ ਕਰਿਆ ਵੀ ਮੇਰੀ ਆਹ ਮ ਦਿੱਕਤ ਆ ਗਈ ਅਤੇ ਵੀ ਮੈਂ ਮੋਟਰਸਾਈਕਲ ਨੂੰ ਮੈਂ ਪੈਂਚਰ ਲਵਾਉਣਾ ਵੀ ਹੁਣ ਮੈਂ ਕਿਵੇਂ ਕਰਾਂ ਫਿਰ ਉਹ ਮੇਰਾ ਮਿੱਤਰ ਆਪਣੇ ਘਰ ਦੇ ਕੋਲ ਤੋਂ ਇੱਕ ਮੋਟਰ ਮਿਸਤਰੀ ਨੂੰ ਮ ਪੈਂਚਰ ਲਗਾਉਣ ਨੂੰ ਨਾਲ ਲੈ ਕੇ ਆਇਆ ਦਸ ਵੀਹ ਕਿਲੋਮੀਟਰ 'ਤੇ ਮੇਰਾ ਫਿਰ ਉਹਨਾਂ ਨੇ ਮੋਟਰਸਾਈਕਲ ਨੂੰ ਪੈਂਚਰ ਲਵਾ ਕੇ ਮੈਨੂੰ ਮੈਂ ਆਪਣੇ ਅਗਲੇ ਸਫ਼ਰ ਲਈ ਤਿਆਰ ਹੋਇਆ ਠੀਕ ਆ ਜੀ